ਭਾਰਤ ਵਿੱਚ ਨੌਕਰੀਆਂ ਦਾ ਬੁਰਾ ਹਾਲ ਹੈ ਕਿਉਂਕਿ ਅੱਜ ਕੱਲ੍ਹ ਭਾਰਤ ਵਿੱਚ ਬੱਚੇ ਆਇਲਸ ਆਈਲੈਟਸ ਕਰਕੇ ਬਾਹਰ ਜਾ ਰਹੇ ਹਨ ਇੱਧਰ ਨੌਕਰੀਆਂ ਹੈ ਨਹੀਂ ਇਸ ਕਰਕੇ ਬਿਚਾਰੇ ਬੱਚੇ ਬੱਚਿਆਂ ਨੂੰ ਮਜਬੂਰ ਹੋ ਕੇ ਭਾਰਤ ਛੱਡ ਕੇ ਜਾਣਾ ਪੈ ਰਿਹਾ ਹੈ ਜੇਕਰ ਸਰਕਾਰ ਕੁਛ ਇੱਧਰ ਹੀ ਉਪਰਾਲਾ ਕਰੇ ਵੀ ਬੱਚੇ ਇੱਥੇ ਹੀ ਰਹਿਣ ਔਰ ਨੌਕਰੀਆਂ ਵਧੀਆ ਮਿਲ ਜਾਣ ਫਿਰ ਮਾਂ ਬਾਪ ਨੂੰ ਵੀ ਇੰਨਾ ਪੈਸਾ ਖਰਚਣ ਦੀ ਲੋੜ ਨਹੀਂ ਹੈ ਔਰ ਪੰਜਾਬ ਦੀ ਪੰਜਾਬ ਤਰੱਕੀ ਦੇ ਰਾਹ 'ਤੇ ਹੀ ਜਾਵੇਗਾ ਪਰ ਜੇਕਰ ਨੌਕਰੀਆਂ ਹੈ ਹੀ ਨਹੀਂ ਤਾਂ ਮਾਂ ਬਾਪ ਨੂੰ ਵੀ ਮਜਬੂਰ ਹੋ ਕੇ ਬਾਹਰ ਭੇਜਣਾ ਪੈਂਦਾ ਹੈ ਅੱਜ ਕੱਲ੍ਹ ਬੜੀਆਂ ਬੜੀਆਂ ਕੰਪਨੀਆਂ ਵਿੱਚ ਦੂਰ ਦੂਰ ਨੌਕਰੀਆਂ ਹੈਗੀਆਂ ਪਰ ਇੱਥੇ ਆਪਣੇ ਲੋਕਲ ਨੌਕਰੀਆਂ ਕੁਛ ਵੀ ਨਹੀਂ ਹੈਗੀਆਂ ਕਿਰਪਾ ਕਰਕੇ ਨੌਕਰੀਆਂ ਵੱਧ ਤੋਂ ਵੱਧ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਮਾਂ ਬਾਪ ਨੂੰ ਵੀ ਆਪਣੇ ਬੱਚਿਆਂ ਨੂੰ ਦੂਰ ਨਹੀਂ ਭੇਜਣਾ ਪੈਣਾ ਅਤੇ ਬੱਚੇ ਤਰੱਕੀ ਦੇ ਰਾਹ 'ਤੇ ਇੱਥੇ ਹੋਣ ਤਾਂ ਦੇਸ਼ ਆਪਣਾ ਖੁਸ਼ਹਾਲੀ ਦੇ ਰਾਹ ਵਿੱਚ ਹੋਵੇ ਦੇਸ਼ ਦੀ ਤਰੱਕੀ ਤਾਂ ਹੀ ਹੋ ਸਕਦੀ ਹੈ ਜੇ ਇੱਧਰ ਨੌਕਰੀਆਂ ਹੋਣ ਪਰ ਜੇ ਨੌਕਰੀਆਂ ਹੈ ਹੀ ਨਹੀਂ ਤਾਂ ਤਰੱਕੀ ਵੀ ਕੀ ਹੋ ਸਕਦੀ ਹੈ ਆਪਣੇ ਘਰ ਆਪਣੀ ਜਮੀਨ ਆਪਣੇ ਦੇਸ਼ ਨਾਲ ਬੱਚਾ ਰਹਿੰਦਾ ਕਨੈਕਟ ਰਹਿੰਦਾ ਆ ਆਪਣੀ ਧਰਤੀ ਨਾਲ ਪਿਆਰ ਵਧੂਗਾ ਪਰ ਜੇ ਵਿਦੇਸ਼ ਦੀ ਧਰਤੀ 'ਤੇ ਜਾ ਕੇ ਹੀ ਨੌਕਰੀ ਕਰਨੀ ਹਾਂ ਫਿਰ ਆਪਣੇ ਇੱਥੇ ਇੰਨਾ ਪੈਸਾ ਖਰਚਣ ਦੀ ਕੋਈ ਲੋੜ ਹੀ ਨਹੀਂ ਹੈਗੀ ਉਹ ਆਪਣਾ ਫਿਊਚਰ ਫਿਰ ਉੱਧਰ ਬਣਾਉਂਦੇ ਨੇ ਦੁਬਾਰਾ ਬੱਚੇ ਇੱਧਰ ਆਉਂਦੇ ਨਹੀਂ ਜੇਕਰ ਨੌਕਰੀਆਂ ਹੋਣ ਮਾਂ ਬਾਪ ਨੂੰ ਵੀ ਕੋਈ ਤੰਗੀ ਪੇਸ਼ੀ ਦਾ ਨਹੀਂ ਹੋਊਗਾ ਮਾਂ ਬਾਪ ਆਪਣੇ ਬੱਚੇ ਤੋਂ ਨੌਕਰੀਆਂ ਦੀ ਵਜ੍ਹਾ ਨਾਲ ਦੂਰ ਹੋ ਰਹੇ ਨੇ ਪਰ ਤਾਂ ਬਾਪ ਮਤਲਬ ਕਿ ਬੱਚਿਆਂ ਨੂੰ ਬਾਹਰ ਜਾਣਾ ਪੈ ਰਿਹਾ ਤਾਂ ਮਾਂ ਬਾਪ ਇੱਧਰ ਰਹੀ ਜਾਂਦੇ ਨੇ ਉੱਧਰ ਬੱਚੇ ਉੱਧਰ ਰਹੀ ਜਾਂਦੇ ਨੇ ਅਤੇ ਉਹ ਆਪਣੀ ਮਾਂ ਬੋਲੀ ਵੀ ਭੁੱਲੀ ਜਾਂਦੇ ਨੇ ਆਪਣੇ ਦੇਸ਼ ਨਾਲ ਵੀ ਨਹੀਂ ਅਟੈਚ ਰਹਿ ਰਹੇ ਅਤੇ ਆਪਣੀ ਹਿਸਟਰੀ ਬਾਰੇ ਵੀ ਉਹਨਾਂ ਨੂੰ ਕੁਛ ਵੀ ਨਹੀਂ ਪਤਾ ਹੈਗਾ ਵੀ ਇਹ ਕੀ ਕੁਛ ਹੋ ਰਿਹਾ